ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਅੰਮ੍ਰਿਤਸਰ ਤੋਂ ਪਠਾਨਕੋਟ ਆਈ ਜੇ ਅਤੇ ਮੈਂ ਇੱਕ ਫੂਡ ਹਾਂ ਮੈਂ ਇੱਕ ਫੂਡ ਵਲੋਗਰ ਆ ਹਾਂਜੀ ਅਤੇ ਇੱਥੇ ਮ ਮੈਨੂੰ ਦੱਸਿਓ ਸਭ ਤੋਂ ਵਧੀਆ ਮਤਲਬ ਕਿ ਖਾਣ ਪੀਣ ਦਾ ਕਿੱਥੇ ਮਿਲਦਾ ਜੀ ਸਮਾਨ ਹਾਂਜੀ ਅਤੇ ਸਮਾਨ ਮਤਲਬ ਕਿ ਸਸਤਾ ਜੇ ਠੀਕ ਠਾਕ ਰੇਟ 'ਚ ਆ ਠੀਕ ਹੈ ਅਤੇ ਫਰੈਸ਼ ਸਮਾਨ ਮਿਲਦਾ ਜੇ ਅਤੇ ਇਹ ਮਤਲਬ ਕਿ ਕਾਫੀ ਦੇਰ ਤੱਕ ਖੁੱਲ੍ਹੀ ਹੁੰਦੀ ਕਿੰਨਾ ਟਾਈਮ ਇਹਦਾ ਖੁੱਲ੍ਹਣ ਦਾ ਠੀਕ ਆ ਠੀਕ ਆ ਧੰਨਵਾਦ